ਸਾਡੇ ਸੱਭਿਆਚਾਰ ਵਿੱਚ ਔਰਤਾਂ ਵਿੱਚ ਮਹਾਂਮਾਰੀ ਦਾ ਇਲਾਜ ਇਵੇਂ ਕੀਤਾ ਜਾਂਦਾ ਹੈ ਕੀ ਜਿਵੇਂ ਕਈ ਔਰਤਾਂ ਨੂੰ ਟਾਈਮ ਸਿਰ ਮਹਾਂਵਾਰੀ ਨਹੀਂ ਆਉਂਦੀ ਹੈ ਜਾਂ ਕਿਸੇ ਨੂੰ ਬਹੁਤ ਜ਼ਿਆਦਾ ਆਉਂਦੀ ਆ ਕਈਆਂ ਨੂੰ ਤਾਂ ਇਹ ਪ੍ਰੋਬਲਮ ਹੁੰਦੀ ਹੈ ਕੀ ਕਈਆਂ ਦੇ ਪੇਟ ਵਿੱਚ ਬਹੁਤ ਦਰਦ ਹੁੰਦੀ ਹੈ ਇਨ ਸਭ ਦਾ ਇਲਾਜ ਡੋਕਟਰਾਂ ਦੇ ਰਾਹੀਂ ਕਰਵਾਇਆ ਜਾਂਦਾ ਹੈ ਅਤੇ ਜਾਂ ਮਹਾਂਵਾਰੀ ਦੌਰਾਨ ਔਰਤਾਂ ਨੂੰ ਪਾਲਣ ਕਰਨ ਲਈ ਕੁਝ ਨਿਯਮ ਹਨ ਜਿਵੇਂ ਕਿ ਔਰਤਾਂ ਨੂੰ ਮਹਾਂਵਾਰੀ ਦੇ ਦੌਰਾਨ ਉਹਨਾਂ ਦਿਨਾਂ ਵਿੱਚ ਉਨ੍ਹਾਂ ਨੂੰ ਆਰਾਮ ਦੀ ਬਹੁਤ ਲੋੜ ਹੁੰਦੀ ਹੈ ਉਹ ਆਪਣੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਣ ਅਤੇ ਆਪਣੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਣ ਇਹ ਨਿਯਮ ਹਨ ਜੋ ਕਿ ਸਨ ਔਰਤਾਂ ਨੂੰ ਮਹਾਂਵਾਰੀ ਦੇ ਦੌਰਾਨ ਅਪਣਾਉਣੇ ਚਾਹੀਦੇ ਹਨ ਕਿ ਉਹ ਕੁਛ ਭਾਰਾ ਕੰਮ ਨਾ ਕਰਨ ਕਈ ਔਰਤਾਂ ਨੂੰ ਪੇਟ ਦਰਦ ਦੀ ਪ੍ਰੋਬਲਮ ਹੁੰਦੀਆਂ ਹਨ ਇਸ ਕਰਕੇ ਉਹਨਾਂ ਨੂੰ ਉਸ ਸਮੇਂ ਵਿੱਚ ਆਰਾਮ ਦੀ ਲੋੜ ਹੁੰਦੀ ਹੈ ਅਤੇ ਨਾਲੇ ਜਦ ਵੀ ਮਹਾਂਵਾਰੀ ਹੋਵੇ ਤਾਂ ਆਪਣੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਅਤੇ ਹਰੀ ਸਬਜ਼ੀਆਂ ਖਾਣ ਜਿਸ ਕਾਰਨ ਸਾਫ ਸਫਾਈ ਦੇ ਕਾਰਨ ਉਹਨਾਂ ਨੂੰ ਕੋਈ ਸੰਕਰਮਣ ਨਾ ਲੱਗ ਜਾਵੇ ਅਤੇ ਉਹ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖੇ